ਸਾਡੇ ਰਾਜ ਵਿੱਤ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਉਦਯੋਗ ਦੇ ਕਈ ਸਾਧਨ ਹੋ ਸਕਦੇ ਹਨ ਜਿਵੇਂ ਕਿ ਫੈਕਟਰੀਆਂ ਜਾਂ ਕਾਰਖਾਨੇ ਜਿਸ ਤਰ੍ਹਾਂ ਕੀ ਸਾਡੇ ਇੱਧਰ ਕਪਾਸ ਦੀ ਖੇਤੀ ਇੱਕ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਕਪਾਸ ਦੇ ਮੀਲ ਲੱਗ ਸਕਦੇ ਹਨ ਅਤੇ ਹੋਰ ਝੋਨੇ ਦੀ ਖੇਤੀ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਝੋਨੇ ਦੀ ਫ ਫਸਲ ਦੇ ਵੱਢਣ ਤੋਂ ਬਾਅਦ ਕਾਰਖਾਨਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਅਤੇ ਅਗਰ ਕਾਰਖਾਨੇ ਜ਼ਿਆਦਾ ਹੋਣਗੇ ਤਾਂ ਉਦਯੋਗ ਵੀ ਜ਼ਿਆਦਾ ਵਧੇਗਾ ਇਸ ਤੋਂ ਇਲਾਵਾ ਸ਼ੂਗਰ ਮੀਲ ਦੇ ਵੀ ਕਾਫ਼ੀ ਜ਼ਰੂਰਤ ਹੈ ਜਿੰਨੇ ਵੀ ਕਾਰਖਾਨੇ ਇੱਥੇ ਬਣਨਗੇ ਉਹਨਾਂ ਨਾਲ ਆਰਥਿਕ ਸਥਿਤੀ ਲੋਕਾਂ ਦੀ ਮਜ਼ਬੂਤ ਹੋਵੇਗੀ